ਹਾਂਜੀ ਮੇਰਾ ਇੱਕ ਭਰਾ ਹੈ ਜੋ ਕਿ ਮੇਰੇ ਤੋਂ ਛੋਟਾ ਅਤੇ ਤੁਸੀਂ ਸਮਾਨ ਤਾਂ ਨਹੀਂ ਕਹਿ ਸਕਦੇ ਅਸੀਂ ਇੱਕ ਦੂਜੇ ਤੋਂ ਕਾਫੀ ਵੱਖਰੇ ਹਨ ਜੇਕਰ ਤੁਸੀਂ ਬਾਕੀ ਭੈਣ ਭਰਾਵਾਂ ਦੀ ਗੱਲ ਕਰੀਏ ਅਸੀਂ ਜਿਵੇਂ ਕਿ ਸਾਡੇ ਮੁਹੱਲੇ ਵਿੱਚ ਆਸ ਪੜੋਸ ਵਿੱਚ ਜਾਂ ਕੀ ਸਾਡੇ ਕਜ਼ਨਸ ਉਹਨਾਂ ਵਿੱਚ ਵੀ ਅਸੀਂ ਵੇਖ ਕਈਆਂ ਲੋਕਾਂ ਵਿੱਚ ਅਸੀਂ ਵੇਖਦੇ ਆ ਰਹੇ ਹਾਂ ਕਿ ਉਹਨਾਂ ਵਿੱਚ ਵੀ ਵੱਖਰਾਪਣ ਹੀ ਨਜ਼ਰ ਆਉਂਦਾ ਸਮਾਨ ਤਾਂ ਤੁਸੀਂ ਕਹਿ ਸਕਦੇ ਹੋ ਕਿ ਕਿਸੇ ਕਿਸੇ ਭੈਣ ਭਰਾਵਾਂ ਵਿੱਚ ਹੋ ਸਕਦਾ ਬਟ ਜ਼ਿਆਦਾਤਰ ਤੁਸੀਂ ਭੈਣ ਭਰਾਵਾਂ ਵਿੱਚ ਵੱਖਰੇਪਣ ਹੀ ਵੇਖੋਗੇ ਕਿਉਂਕਿ ਕਈ ਚੀਜ਼ਾਂ ਹੈ ਹਨ ਜੋ ਉਹਨਾਂ ਨੂੰ ਪਸੰਦ ਆਉਂਦੀਆਂ ਅਤੇ ਕਈ ਚੀਜ਼ਾਂ ਹਨ ਜੋ ਸਾਨੂੰ ਪਸੰਦ ਆਉਂਦੀਆਂ ਉਸ ਦੇ ਮੁਤਾਬਕ ਸਾ ਸਾਰੇ ਅਸੀਂ ਸਾਡਿਆਂ ਦੀ ਚੋਇਸ ਆਪਣੀ ਵੱਖਰੀ ਵੱਖਰੀ ਹੁੰਦੀ ਹੈ ਇਹ ਨਹੀਂ ਕਿ ਸਾਨੂੰ ਜਿਹੜੀ ਚੀਜ਼ ਪਸੰਦ ਆਈ ਹੈ ਦੂਸਰੇ ਦੂਜੇ ਬੰਦੇ ਨੂੰ ਵੀ ਉਹੀ ਚੀਜ਼ ਪਸੰਦ ਆਏ ਅਸੀਂ ਇਹ ਨਹੀਂ ਕਹਿ ਸਕਦੇ ਲੋਕਾਂ ਦੀ ਆਪਣੀ ਆਪਣੀ ਨਜ਼ਰੀਆ ਹੈ ਆਪਣੀ ਚੀਜ਼ਾਂ ਨੂੰ ਵੇਖਣ ਦਾ ਵੱਖ ਵੱਖ ਚੀਜ਼ਾਂ ਨੂੰ ਵੇਖਣ ਦਾ ਜਿਵੇਂ ਕਿ ਮੇਰੇ ਭਰਾ ਨੂੰ ਗੇਮਾਂ ਦਾ ਬੜਾ ਸ਼ੌਕ ਹੈ ਵੀਡੀਓ ਗੇਮਾਂ ਹੋ ਗਈਆਂ ਮੋਬਾਇਲ 'ਤੇ ਗੇਮਾਂ ਹੋ ਗਈਆਂ ਅਤੇ ਮੈਨੂੰ ਆਪਣਾ ਡਾਂਸਿੰਗ ਕਰਨ ਦਾ ਸ਼ੌਕ ਹੈ ਨੱਚਣ ਦਾ ਸ਼ੌਕ ਹੈ ਅਤੇ ਮੈਨੂੰ ਵੱਖ ਵੱਖ ਤਰ੍ਹਾਂ ਦੀ ਕਿਤਾਬਾਂ ਪੜ੍ਹਨ ਦਾ ਸ਼ੌਕ ਹੈ ਹਾਂ ਤੁਸੀਂ ਕਹਿ ਸਕਦੇ ਹੋ ਕਿ ਮੈਂ ਕਿ ਮੈਨੂੰ ਘੁੰਮਣਾ ਫਿਰਨਾ ਬਹੁਤ ਪਸੰਦ ਹੈ ਅਤੇ ਉਹ ਇਸ ਚੀਜ਼ਾਂ ਤੋਂ ਕਾਫੀ ਹੀ ਅਲੱਗ ਹੈ ਉਸਨੂੰ ਇੰਨਾ ਘੁੰਮਣ ਫਿਰਨ ਇੰਨਾ ਪਸੰਦ ਹੈ ਨਹੀਂ ਹੈ ਅਤੇ ਉਹ ਬਾਹਰ ਜਾ ਕੇ ਵੀ ਚੌਵੀ ਘੰਟੇ ਫੋਨ 'ਤੇ ਹੀ ਲੱਗਿਆ ਰਹਿੰਦਾ ਅਤੇ ਸਾਰਾ ਦਿਨ ਵੀਡੀਓ ਗੇਮਾਂ ਹੋ ਗਈਆਂ ਅਤੇ ਕੁਝ ਹੋ ਗਈਆਂ ਉਹ ਬਾਹਰ ਜਾ ਕੇ ਕੋਈ ਚੀਜ਼ ਇੰਜੋਏ ਨਹੀਂ ਕਰਦਾ ਸਿਰਫ ਫੋਨ ਵਿੱਚ ਹੀ ਲੱਗਿਆ ਰਹਿੰਦਾ ਅਤੇ ਹਾਂ ਤੁਸੀਂ ਕਹਿ ਸਕਦੇ ਹੋ ਕਿ ਅਸੀਂ ਸਮਾਨ ਤਾਂ ਹੈ ਨੀ ਹੈਗੇ ਹਾਂ ਅਤੇ ਅਸੀਂ ਵੱਖਰੇ ਹੀ ਹੈਗੇ ਹਾਂ ਅਤੇ ਕਈ ਲੋਕ ਆਹ ਤੁਸੀਂ ਦੇਖ ਸਕਦੇ ਹੋ ਤੁਹਾਡੇ ਗਲੀ ਮੁਹੱਲੇ ਵਿੱਚ ਉਹ ਵੀ ਭੈਣ ਭਰਾਵਾਂ ਉਹ ਵੀ ਵੱਖਰੇ ਹੀ ਹਨ ਕਈ ਕਈ ਲੋਕ ਸਮਾਨ ਹੁੰਦੇ ਆ ਅਤੇ ਕਈ ਲੋਕ ਵੱਖਰੇ ਹੀ ਹੁੰਦੇ ਹਨ